ਮੈਂ ਹਰ ਇੱਕ ਤਿਉਹਾਰ 'ਤੇ ਮੂਰਤੀਆਂ ਖੁਦ ਹੀ ਬਣਾਉਂਦੀ ਹਾਂ ਜਿਵੇਂ ਕਿ ਗਨੇਸ਼ ਚਤੁਰਥੀ 'ਤੇ ਮੈਂ ਉਹਨਾਂ ਦੀ ਮੂਰਤੀ ਖੁਦ ਹੀ ਬਣਾਈ ਸੀ ਇਸੇ ਤਰ੍ਹਾਂ ਹੁਣ ਦੁਰਗਾ ਪੂਜਾ ਹੈ ਹੁੰਦੀ ਹੈ ਅਤੇ ਮੈਂ ਉਹਨਾਂ ਦੀ ਮੂਰਤੀ ਵੀ ਖੁਦ ਹੀ ਬਣਾ ਰਹੀ ਹਾਂ ਇਹਨਾਂ ਦਿਨਾਂ ਵਿੱਚ ਸਾਡੇ ਸਾਂਝੀ ਮਾਤਾ ਵੀ ਲਗਾਈ ਜਾਂਦੀ ਹੈ ਜਿਨ੍ਹਾਂ ਦੇ ਵੱਖ ਵੱਖ ਆਕਾਰ ਬਣਾਏ ਜਾਂਦੇ ਹਨ ਅਤੇ ਉਹਨਾਂ ਨੂੰ ਬਹੁਤ ਵਧੀਆ ਰੰਗਾਂ ਨਾਲ ਸਜਾਇਆ ਜਾਂਦਾ ਹੈ ਅਤੇ ਜਿਹੜੀ ਮੈਂ ਮੂਰਤੀਆਂ ਬਣਾਉਂਦੀ ਹਾਂ ਉਹਨਾਂ ਨੂੰ ਕੁਛ ਦਿਨਾਂ ਬਾਅਦ ਵਿਸਰਜਨ ਵੀ ਕਰਨਾ ਪੈਂਦਾ ਹੈ ਜਿਸ ਨਾਲ ਕਿ ਪਾਣੀ ਦਾ ਨਦੀਆਂ ਦਾ ਜੋ ਪਾਣੀ ਹੁੰਦਾ ਉਹ ਪ੍ਰਦੂਸ਼ਿਤ ਨਹੀਂ ਹੁੰਦਾ ਹੈ ਮੈਨੂੰ ਇਹ ਸਭ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਕਿਉਂਕਿ ਇਹਨਾਂ ਚੀਜ਼ਾਂ ਨਾਲ ਏਕਤਾ ਵੱਧਦੀ ਹੈ